ਪੰਜਾਬੀ ਭਾਸ਼ਾ ਅਕਸਰ ਹੀ ਭਾਰਤੀ ਭਾਸ਼ਾ ਹਿੰਦੀ ਦੇ ਨਾਲ ਤੋਲਣਾ ਕਰਦੀ ਹੈ ਸਾਰੇ ਭਾਰਤ ਦੇ ਵਿੱਚ ਪੰਜਾਬੀ ਭਾਸ਼ਾ ਜਿਆਦਾਤਰ ਬੋਲੀ ਜਾਂਦੀ ਹੈ ਕਿਉਂਕਿ ਪੰਜਾਬੀ ਕਾਫੀ ਕੰਟਰੀਜ਼ ਦੇ ਵਿੱਚ ਜਾਂਦੇ ਹਨ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਕਾਫੀ ਹੱਦ ਤੱਕ ਬੋਲੀ ਜਾਂਦੀ ਹੈ ਜਿਵੇਂ ਕਿ ਪੰਜਾਬੀ ਭਾਸ਼ਾ ਜੋ ਵਿਅਕਤੀ ਪੰਜਾਬੀ ਭਾਸ਼ਾ ਜਾਣਦਾ ਹੈ ਉਹਨੂੰ ਹਿੰਦੀ ਭਾਸ਼ਾ ਵੀ ਆਉਂਦੀ ਹੁੰਦੀ ਹੈ ਕਿਉਂਕਿ ਪੰਜਾਬੀ ਭਾਸ਼ਾ ਤੇ ਹਿੰਦੀ ਭਾਸ਼ਾ ਦਾ ਆਪਸ ਦੇ ਵਿੱਚ ਤਾਲਮੇਲ ਹੁੰਦਾ ਹੈ ਅਤੇ ਇਹ ਆਪਸ ਦੇ ਵਿੱਚ ਮੈਚ ਖਾਂਦੀਆਂ ਹਨ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਇਹਨਾਂ ਦੇ ਵਿੱਚ ਬਹੁਤ ਘੱ ਘੱਟ ਹੀ ਅੰਤਰ ਹੈ ਅੱਜ ਕੱਲ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਜਿਵੇਂ ਕਿ ਅਸੀਂ ਕਨੇਡਾ ਅਮਰੀਕਾ ਆਦਿ ਦੇਸ਼ਾਂ ਨੂੰ ਲੈ ਸਕਦੇ ਹਾਂ ਕਿਉਂਕਿ ਇੱਥੇ ਜਿਆਦਾਤਰ ਪੰਜਾਬੀ ਗਏ ਹਨ ਅਤੇ ਉਥੇ ਵੀ ਹੁਣ ਪੰਜਾਬੀ ਹੀ ਜਿਆਦਾਤਰ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਕਈ ਸਾਰੇ ਸ਼ਬਦ ਜਿਹੜੇ ਕਿ ਬਹੁਤ ਹੀ ਜਿਆਦਾ ਸਪਸ਼ਟ ਹੁੰਦੇ ਹਨ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਬੋਲੇ ਜਾਂਦੇ ਹਨ ਤੇ ਬਹੁਤ ਵਧੀਆ ਸਮਝੇ ਜਾਂਦੇ ਹਨ ਅਤੇ ਇਹ ਅਕਸਰ ਹੀ ਹਿੰਦੀ ਭਾਸ਼ਾ ਦੀ ਤੁਲਨਾ ਦੇ ਵਿੱਚ ਪੰਜਾਬੀ ਭਾਸ਼ਾ ਬਹੁਤ ਜਿਆਦੇ ਵਧੀਆ ਹੈ ਅਤੇ ਇਹ ਆਪਸ ਦੇ ਵਿੱਚ ਮੇਲ ਖਾਂਦੀਆਂ ਹਨ ਪੰਜਾਬੀ ਭਾਸ਼ਾ ਤੇ ਹਿੰਦੀ ਭਾਸ਼ਾ ਦੇ ਵਿੱਚ ਕੋਈ ਜਿਆਦਾ ਫਰਕ ਜਾਂ ਅੰਤਰ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਅਤੇ ਸਾਰੇ ਹੀ ਦੇਸ਼ਾਂ ਦੇ ਪੰਜਾਬ ਦੇ ਸਾਰੇ ਹੀ ਜਿਲਿਆਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਇੱਕ ਮਹੱਤਵਪੂਰਨ ਮਹੱਤਵ ਮਤਲਬ ਹੈ ਅਤੇ ਇਹ ਜਿਹੜੇ ਪੰਜਾ ਜਿਹੜੇ ਕਿ ਪੰਜਾਬ ਦੇ ਗ੍ਰੰਥ ਵੀ ਹਨ ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਹੀ ਲਿਖੇ ਗਏ ਹਨ ਅਤੇ ਜਿਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਸੀਂ ਆਪਣੇ ਸਕੂਲਾਂ ਕਾਲਜਾਂ ਦੇ ਵਿੱਚ ਬਚਪਨ ਤੋਂ ਹੀ ਪੰਜਾਬੀ ਪੜ੍ਹਦੇ ਹਾਂ ਅਤੇ ਪੰਜਾਬੀ ਭਾਸ਼ਾ ਬਹੁਤ ਹੀ ਜਿਆਦਾ ਜਰੂਰੀ ਹੈ